ਪੰਜਾਬ ਸਾਡਾ ਮਨਪਸੰਦ ਰਾਜ ਹੈ ਇੱਥੇ ਸੂਰਬੀਰਾਂ ਨੇ ਜਨਮ ਲਿਆ ਹੈ ਅਤੇ ਯੋਧੇ ਪੀਰਾਂ ਨੇ ਜਨਮ ਲਿਆ ਹੈ ਪੰਜਾਬ ਦੇ ਪਿੰਡਾਂ ਵਿੱਚ ਰੌਣਕ ਵਸਦੀ ਹੈ ਪੰਜਾਬ ਦੇ ਪਿੰਡਾਂ ਵਿੱਚ ਹਰਿਆਲੀ ਹੀ ਹਰਿਆਲੀ ਹੈ ਇੱਥੋਂ ਦਾ ਰਹਿਣ ਸਹਿਣ ਅਤੇ ਖਾਣ ਪੀਣ ਬਹੁਤ ਵਧੀਆ ਹੈ ਪੰਜਾਬ ਵਿੱਚ ਦੇਖਣ ਯੋਗ ਜਗ੍ਹਾ ਬਹੁਤ ਸੋਹਣੀਆਂ ਹਨ ਜਿੱਦਾਂ ਅਨੰਦਪੁਰ ਸਾਹਿਬ ਤਰਨ ਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਕੇਸਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਇੱਥੇ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਹਨ ਇਸ ਤਰ੍ਹਾਂ ਹੀ ਕਈ ਹੋਰ ਥਾਵਾਂ ਹਨ ਜਿੱਥੇ ਕਿ ਅਸੀਂ ਆਪਣੇ ਇਤਿਹਾਸ ਬਾਰੇ ਜਾਣਦੇ ਹਾਂ ਇੱਥੇ ਵੱਡੇ ਵੱਡੇ ਯੋਧੇ ਸੂਰਵੀਰ ਸ਼ਹੀਦ ਹੋਏ ਹਨ ਜਿੱਦਾਂ ਸ਼ ਬਾਬਾ ਦੀਪ ਸਿੰਘ ਜੀ ਸ਼ਹੀਦ ਇਹਨਾਂ ਦਾ ਜਨਮ ਸਥਾਨ ਪਹੁਵਿੰਡ ਸਾਹਿਬ ਹੈ ਇਹ ਵੀ ਦੇਖਣ ਯੋਗ ਜਗ੍ਹਾ ਹੈ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਵਿੱਚ ਸਾਡੇ ਕਈ ਇਤਿਹਾਸਿਕ ਜਗ੍ਹਾ ਹੈ ਅਤੇ ਸਾਡੇ ਪਿਛੋਕੜ ਬਾਰੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਵੀ ਸਾਡੇ ਪੰਜਾਬ ਵਿੱਚ ਕੀ ਕੀ ਹੁੰਦਾ ਹੈ ਅਤੇ ਸਾਡਾ ਸੱਭਿਆਚਾਰਕ ਨਾਲ ਸਾਡੇ ਬੱਚਿਆਂ ਨੂੰ ਜੋੜੇਗਾ ਸਾਡੇ ਪੰਜਾਬ ਵਿੱਚ ਕਈ ਇਹੋ ਜਿਹੀਆਂ ਜਗ੍ਹਾ ਜਿੱਥੋਂ ਸਾਡੇ ਵਿਰਸੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ